ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੈਂ ਓਲਾ ਬੁੱਕ ਕੀਤੀ ਸੀ ਕਿੱਥੇ ਰਹਿ ਗਏ ਹੋ ਟਾਈਮ ਲੰਘੀ ਜਾ ਰਿਹਾ ਸਰ ਜਲਦੀ ਆ ਜਾਓ ਪਲੀਜ਼ ਜਾਂ ਤਾਂ ਪਹਿਲਾਂ ਮਤਲਬ ਨਹੀਂ ਸੀਗੀ ਪਿੱਕ ਕਰਨੀ ਇੱਥੇ ਖੜ੍ਹਾ ਮੈਂ ਕਾਫ਼ੀ ਦੇਰ ਤੋਂ ਸੁਜਾਨਪੁਰ ਖੜ੍ਹਾ ਸਰ ਮੈਂ ਜਲਦੀ ਕਰ ਲਓ ਸਰ ਟਾਈਮ ਲੰਘੀ ਜਾਂਦਾ ਮੈਂ ਮੇਰੀ ਫਲਾਈਟ ਆ ਬੈਂਗਲੋਰ ਦੀ

ਸਰ ਪਲੀਜ਼ ਮਤਲਬ ਜਲਦੀ ਆਓ ਥੋੜ੍ਹਾ ਜੇ ਮਤਲਬ ਨਹੀਂ ਤੁਹਾਡੇ ਤੋਂ ਪੋਸੀਬਲ ਜਲਦੀ ਨਹੀਂ ਆ ਸਕਦੇ ਤਾਂ ਕੈਂਸਲ ਕਰ ਦਿੱਤੀ ਜਾਵੇ ਹਾਂਜੀ ਵੀ ਟਾਈਮ ਕਾਫ਼ੀ ਬੀਤ ਗਿਆ ਅਤੇ ਮੇਰੀ ਫਲਾਈਟ ਦੇ ਪੈਸੇ ਵੀ ਨਹੀਂ ਰਿਫੰਡ ਹੋਣੇ ਹੈਗੇ ਅੱਗੋਂ ਹਾਂਜੀ ਅਤੇ ਮਤਲਬ ਜਲਦੀ ਤੋਂ ਜਲਦੀ ਪਹੁੰਚਿਆ ਜਾਵੇ ਹੈਗੇ ਹੈਗੇ ਕਿੱਥੇ ਹੋ ਤੁਸੀਂ ਹਾਲੇ ਹਾਂਜੀ ਅਤੇ ਜੇ ਇਹਦੇ ਤੋਂ ਮਤਲਬ ਕਾਫ਼ੀ ਟਾਈਮ ਲੱਗਣਾ ਅਜੇ ਵੀ ਤਾਂ ਦੇਖ ਲਓ ਸਰ ਮੈਂ ਰਾਈਡ ਕੈਂਸਲ ਕਰ ਦਿੰਦਾ ਹਾਂਜੀ ਅਤੇ ਨਵੀਂ ਬੁੱਕ ਕਰ ਲੈਂਦਾ ਹਾਂਜੀ ਹਾਂਜੀ ਹਾਂਜੀ ਚਲੋ ਆ ਜਾਓ ਫਿਰ ਆ ਜਾਓ ਆ ਜਾਓ ਓਕੇ ਥੈਂਕ ਯੂ ਸਰ